ਅੱਜ ਦੇ ਸਮੇਂ ਦੇ ਵਿੱਚ ਸਾਨੂੰ ਸੜਕ ਸੜਕ 'ਤੇ ਬਹੁਤ ਜ਼ਿਆਦਾ ਧਿਆਨ ਨਾਲ ਚੱਲਣਾ ਪੈਂਦਾ ਹੈ ਕਿਉਂਕਿ ਅੱਜ ਦੀ ਘੜੀ ਦੇ ਵਿੱਚ ਬਹੁਤ ਜ਼ਿਆਦਾ ਹਾਦਸੇ ਹੋ ਰਹੇ ਹਨ ਜੋ ਕਿ ਲੋਕਾਂ ਦੇ ਲ ਲਈ ਬਹੁਤ ਜ਼ਿਆਦਾ ਨੁਕਸਾਨਦੇਹ ਹਨ ਅਤੇ ਪਰਿਵਾਰ ਵਾਸਤੇ ਵੀ ਨੁਕਸਾਨਦੇਹ ਹਨ ਜਿਵੇਂ ਕਿ ਅੱਜ ਦੀ ਘੜੀ ਦੇ ਵਿੱਚ ਲੋਕ ਡਰਿੰਕ ਐਂਡ ਡਰਾਈਵ ਬਹੁਤ ਜ਼ਿਆਦਾ ਕਰ ਰਹੇ ਹਨ ਜਿਸਦੇ ਕਾਰਨ ਕੀ ਹੈ ਮਾਸੂਮ ਇਨਸਾਨ ਬਹੁਤ ਜ਼ਿਆਦਾ ਤਕਲੀਫ ਝੇਲ ਰਹੇ ਹਨ ਅਤੇ ਉਸਦਾ ਕੋਈ ਸਟੈ ਇਲਾਜ ਵੀ ਨਹੀਂ ਕਰ ਰਿਹਾ ਅਤੇ ਅੱਜ ਦੀ ਘੜੀ ਦੇ ਵਿੱਚ ਪੁਲਿਸ ਵੀ ਰਿਸ਼ਵਤ ਦੇ ਕੇ ਛੱਡ ਦਿੰਦੀ ਹੈ ਪਰੰਤੂ ਸਾਨੂੰ ਬਹੁਤ ਜ਼ਿਆਦਾ ਧਿਆਨ ਜਦੋਂ ਅਸੀਂ ਸੜਕ 'ਤੇ ਚੱਲੀਏ ਤਾਂ ਸਾਨੂੰ ਬਹੁਤ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਜਿਵੇਂ ਕਿ ਸਾਨੂੰ ਖੱਬੇ ਪਾਸੇ ਸੜਕ ਦੇ ਹਮੇਸ਼ਾ ਚੱਲਣਾ ਚਾਹੀਦਾ ਹੈ ਕਿਉਂਕਿ ਖੱਬਾ ਪਾਸਾ ਹੀ ਸਾਡਾ ਸਹੀ ਪਾਸਾ ਹੈ ਜੋ ਕਿ ਸਾਨੂੰ ਸਿੱਧਾ ਚੱਲਣ ਦੇ ਵਿੱਚ ਬਹੁਤ ਜ਼ਿਆਦਾ ਮਦਦ ਕਰਦਾ ਹੈ ਅਤੇ ਨਾਲ ਦੀ ਨਾਲ ਸਾਨੂੰ ਹਰ ਲੀਗਲ ਡੋਕੂਮੈਂਟ ਜਿਵੇਂ ਕਿ ਸਾਡੇ ਬਾਈਕ ਦੀ ਆਰ ਸੀ ਸਾਡਾ ਡਰਾਈਵਿੰਗ ਲਾਇਸੈਂਸ ਪੋਲੀਊਸ਼ਨ ਅਤੇ ਆਰ ਸੀ ਰੱਖਣਾ ਜ਼ਰੂਰੀ ਹੈ ਆਰ ਸੀ ਕੀ ਹੈ ਆਰ ਸੀ ਇੱਕ ਉਹ ਪਰਮਿਟ ਹੈ ਸਾਡੀ ਵਹੀਕਲ ਦਾ ਜੋ ਕਿ ਸਾਨੂੰ ਸੜਕ ਦੇ ਉੱਤੇ ਚੱਲਣ ਦੇ ਲਈ ਮਦਦ ਕਰਦਾ ਹੈ ਡਰਾਈਵਿੰਗ ਲਾਇਸੈਂਸ ਕੀ ਹੈ ਡਰਾਈਵਿੰਗ ਲਾਇਸੈਂਸ ਉਹ ਹੈ ਜੋ ਕਿ ਸਾਨੂੰ ਜੋ ਸਾਨੂੰ ਗੱਡੀ ਚਲਾਉਣ ਦੇ ਲਈ ਮਦਦ ਕਰਦਾ ਹੈ ਜੇਕਰ ਕੋਈ ਪੁਲਿਸ ਵਾਲਾ ਰੋਕ ਲੈਂਦਾ ਹੈ ਉਹ ਸਭ ਤੋਂ ਪਹਿਲਾਂ ਆਰ ਸੀ ਅਤੇ ਡਰਾਈਵਿੰਗ ਲਾਇਸੈਂਸ ਹੀ ਮੰਗਦਾ ਹੈ ਕਿਉਂਕਿ ਉਹ ਦੋਨੇ ਹੀ ਬਹੁਤ ਜ਼ਰੂਰੀ ਬਹੁਤ ਇੰਪੋਰਟੈਂਟ ਡਾਟਾ ਹੁੰਦਾ ਹੈ ਜੋ ਕਿ ਸਾਨੂੰ ਸੜਕ ਦੇ ਉੱਤੇ ਵਾਹਨ ਚਲਾਉਣ ਦੇ ਲਈ ਮਦਦ ਕਰਦਾ ਹੈ ਇਨਸ਼ੋਰੈਂਸ ਅਤੇ ਪੋਲਿਊਸ਼ਨ ਕੀ ਹੈ ਇਨਸ਼ੋਰੈਂਸ ਅਤੇ ਪੋਲਿਊਸ਼ਨ ਉਹ ਚੀਜ਼ ਹਨ ਜੋ ਕਿ ਇੰਸ਼ਾ ਇਨਸ਼ੋਰੈਂਸ ਤਾਂ ਉਹ ਹੈ ਜੋ ਕਿ ਸਾਡੇ ਵਾਹੀਕਲ ਨੂੰ ਬਚਾ ਕੇ ਰੱਖਦਾ ਹੈ ਜੇਕਰ ਸਾਡੇ ਸਾਡੇ ਵਹੀਕਲ ਦੇ ਨਾਲ ਜੇਕਰ ਕੋਈ ਹਾਦਸਾ ਹੁੰਦਾ ਹੈ ਉਹ ਹਾਦਸੇ ਦੇ ਬਾਅਦ ਜਦੋਂ ਵੀ ਸਾਨੂੰ ਆਪਣਾ ਵਾਹੀਕਲ ਸਹੀ ਕਰਵਾਉਣਾ ਹੋਵੇ ਉਹ ਇਨਸ਼ੋਰੈਂਸ ਵਾਲੇ ਹੀ ਪੈਸੇ ਦਿੰਦੇ ਹਨ ਕਿਉਂਕਿ ਸਾਡਾ ਵਹੀਕਲ ਕਿਸੇ ਦੇ ਅੰਡਰ ਹੁੰਦਾ ਹੈ ਤਾਂ ਕਿ ਉਹ ਸਾਨੂੰ ਪੈਸੇ ਸਾਨੂੰ ਸਾਡੇ ਉਹ ਪੈਸੇ ਬਚਾ ਸਕੇ ਤਾਂ ਕਿ ਇਸ ਲਈ ਅਸੀਂ ਆਪਣੀ ਬਾਇਕ ਦੀ ਇਨਸ਼ੋਰੈਂਸ ਕਰਵਾ ਕੇ ਰੱਖਦੇ ਹਨ ਅਤੇ ਨਾਲ ਨਾਲ ਅਤੇ ਵਾਹੀਕਲ ਦਾ ਪੋਲੀਊਸ਼ਨ ਉਹ ਹੁੰਦਾ ਹੈ ਜੋ ਕਿ ਸਾਡੇ ਤ ਉਹ ਤੱਤਾਂ ਨੂੰ ਮੈਜ਼ਰ ਕਰਦਾ ਹੈ ਕਿ ਜਿਹੜਾ ਸਾਡਾ ਵਾਹੀਕਲ ਹੈ ਉਹ ਕੋਈ ਪ੍ਰਦੂਸ਼ਣ ਤਾਂ ਨਹੀਂ ਫੈਲਾ ਰਿਹਾ ਸਾਡੇ ਇਨਵਾਇਰਮੈਂਟ ਦੇ ਵਿੱਚ ਨਾਲੇ ਸਾਨੂੰ ਹਮੇਸ਼ਾ ਸਪੀਡ ਲਿਮਿਟ ਦੇ ਵਿੱਚ ਹੀ ਆਪਣਾ ਵਹੀਕਲ ਚਲਾਉਣਾ ਚਾਹੀਦਾ ਹੈ ਜੇਕਰ ਅਸੀਂ ਓਵਰ ਸਪੀਡਿੰਗ ਕਰਦੇ ਹਾਂ ਤਾਂ ਸਾਡੇ ਲਈ ਉਹ ਬਹੁਤ ਜ਼ਿਆਦਾ ਨੁਕਸਾਨਦੇਹ ਹੈ ਅਤੇ ਨਾਲੇ ਉਸਦੀ ਕੋਈ ਸੀਮਾ ਵੀ ਨਹੀਂ ਹੁੰਦੀ ਜੇ ਸੜਕ ਹਾਦਸੇ ਅੱਧੇ ਤਾਂ ਓਵਰ ਸਪੀਡਿੰਗ ਹੋਣ ਕਰਕੇ ਹੁੰਦੇ ਹਨ ਜਿਵੇਂ ਕਿ ਅੱਜ ਦੀ ਘੜੀ ਦੇ ਵਿੱਚ ਜੋ ਨੌਜਵਾਨ ਹਨ ਉਹ ਓਵਰ ਸਪੀਡਿੰਗ ਦੇ ਓਵਰ ਸਪੀਡਿੰਗ ਦੇ ਚੱਕਰ ਦੇ ਵਿੱਚ ਜਾਂ ਫੁਕਰਪਣ ਪਣੀ ਦੇ ਚੱਕਰ ਦੇ ਵਿੱਚ ਆਪਣਾ ਬਹੁਤ ਜ਼ਿਆਦਾ ਨੁਕਸਾਨ ਕਰਵਾ ਬੈਠਦੇ ਹਨ ਇਹ ਲੋਕ ਸੜਕ ਦੇ ਉੱਤੇ ਹਾਦਸੇ ਕਰਵਾ ਬੈਠਦੇ ਹਨ ਜੋ ਕਿ ਬਹੁਤ ਜ਼ਿਆਦਾ ਨੁਕਸਾਨਦੇਹ ਹੈ ਇਸਦੇ ਨਾਲ ਕੀ ਹੈ ਗੱਡੀਆਂ ਵੀ ਖਤਮ ਹੋ ਜਾਂਦੀਆਂ ਹਨ ਮੋਟਰਸਾਈਕਲ ਵੀ ਖਤਮ ਹੋ ਜਾਂਦੇ ਹਨ ਅਤੇ ਨਾਲ ਦੀ ਨਾਲ ਜਾਨਾਂ ਵੀ ਖਤਮ ਹੋ ਜਾਂਦੀਆਂ ਹਨ ਜੇ ਇੱਦਾਂ ਹੀ ਚੱਲਦਾ ਰਿਹਾ ਤਾਂ ਪੰਜਾਬ ਦੇ ਵਿੱਚ ਇੱਕ ਦਿਨ ਐਸਾ ਹੋਏਗਾ ਕਿ ਬਹੁਤ ਸਾਰੇ ਸੜਕਾਂ ਦੇ ਉੱਤੇ ਹਾਦਸੇ ਹੋਣੇ ਸ਼ੁਰੂ ਹੋ ਜਾਣਗੇ ਜਿਸ ਦੇ ਕਾਰਨ ਕੀ ਹੈ ਸਾਡੀ ਆਬਾਦੀ 'ਤੇ ਬਹੁਤ ਜ਼ਿਆਦਾ ਇਫੈਕਟ ਪੈਂਦਾ ਹੈ ਅਤੇ ਨਾਲੇ ਸਾਡੀ ਪਿਆਰਿਆਂ ਨੂੰ ਵੀ ਸਾਨੂੰ ਖੋਣਾ ਪੈ ਜਾਂਦਾ ਹੈ ਇਸ ਕਰਕੇ ਸਾਨੂੰ ਹਰ ਚੀਜ਼ ਦਾ ਖਿਆਲ ਰੱਖ ਕੇ ਹੀ ਚੱਲਣਾ ਚਾਹੀਦਾ ਜੇਕਰ ਅਸੀਂ ਨਾ ਰੱਖ ਕੇ ਚੱਲੀਏ ਤਾਂ ਸਾਡੇ ਲਈ ਬਹੁਤ ਜ਼ਿਆਦਾ ਨੁਕਸਾਨਦੇਹ ਹੈ ਅਤੇ ਉਸਦੇ ਕਾਰਨ ਕੀ ਹੈ ਸਾਡੀ ਜ਼ਿੰਦਗੀ ਵੀ ਜਾ ਸਕਦੀ ਹੈ ਜੇਕਰ ਨਾ ਰੱਖੀਏ ਜੇਕਰ ਇੱਦਾਂ ਹੀ ਚੱਲਦਾ ਰਿਹਾ ਤਾਂ ਸਾਡੇ ਲਈ ਬਹੁਤ ਜ਼ਿਆਦਾ ਤਕਲੀਫ ਹੋ ਜਾਵੇਗੀ ਅਤੇ ਵੋ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਬਹੁਤ ਜ਼ਿਆਦਾ ਦਿੱਕਤਾਂ ਦਾ ਫੇਸ ਫੇਸ ਕਰਨੀ ਪਵੇਗੀ ਅਤੇ ਜੇਕਰ ਕੋਈ ਬੰਦਾ ਹਾਦਸੇ ਤੋਂ ਬਚ ਜਾਂਦਾ ਹੈ ਜਾਂ ਫਿਰ ਉਹਦਾ ਹੱਥ ਪੈਰ ਟੁੱਟਦਾ ਹੈ ਜਾਂ ਫਿਰ ਉਹਦਾ ਕੋਈ ਹੋਰ ਨੁਕਸਾਨ ਹੋ ਜਾਂਦਾ ਹੈ ਜੇ ਇੱਦਾਂ ਹੀ ਚੱਲਦਾ ਰਿਹਾ ਤਾਂ ਉਹ ਆਉਣ ਵਾਲੀ ਦਿੱਕਤਾਂ ਦਾ ਸਾਹਮਣਾ ਨਹੀਂ ਕਰ ਕਰ ਪਾਉਣਗੇ ਤਾਂ ਉਹ ਮੈਂਟਲੀ ਹੀ ਬਹੁਤ ਜ਼ਿਆਦਾ ਅਪਸੈੱਟ ਹੋ ਜਾਣਗੇ ਅਤੇ ਨਾਲੇ ਹਮੇਸ਼ਾ ਆਪਣੇ ਵਾਹੀਕਲ ਦੇ ਕਾਗਜ਼ ਪੱਤਰ ਪੂਰੇ ਰੱਖਣੇ ਚਾਹੀਦੇ ਹਨ ਜੇਕਰ ਅਸੀਂ ਉਹ ਕਾਗਜ਼ ਪੱਤਰ ਪੂਰੇ ਰੱਖਦੇ ਹਨ ਤਾਂ ਉਹ ਸਾਨੂੰ ਆਉਣ ਵਾਲੀ ਦਿੱਕਤ ਤੋਂ ਵੀ ਬਚਾ ਲੈਂਦੀਆਂ ਹਨ ਅਤੇ ਇੱਦਾਂ ਹੀ ਚੱਲਦਾ ਰਿਹਾ ਤਾਂ ਅਤੇ ਲੋਕਾਂ ਨੂੰ ਜਾਗਰੂਕਤਾ ਵੀ ਦ ਦੇਣੀ ਚਾਹੀਦੀ ਹੈ ਜੇਕਰ ਸਾਨੂੰ ਇੱਦਾਂ ਹੀ ਜਾਗਰੂਕਤਾ ਦੇ ਵੀ ਦਿਖਾਉਣੀ ਚਾਹੀਦੀ ਹੈ ਅਤੇ ਕਿਵੇਂ ਕਿਵੇਂ ਸਾਨੂੰ ਸੜਕਾਂ ਦੇ ਉੱਤੇ ਚੱਲਣਾ ਹੈ ਅਤੇ ਕਿਵੇਂ ਕਿਵੇਂ ਕੀ ਕਰਨਾ ਹੈ ਉਹਦੀ ਵੀ ਜਾਣਕਾਰੀ ਦੇਣੀ ਚਾਹੀਦੀ ਹੈ ਜਿਵੇਂ ਕਿ ਬੱਚੇ ਬੱਚਿਆਂ ਨੂੰ ਸਕੂਲ ਦੇ ਵਿੱਚ ਜਾ ਕੇ ਲੈਕਚਰ ਦੇਣੇ ਚਾਹੀਦੇ ਹਨ ਕਿ ਕਿਵੇਂ ਸੜਕ 'ਤੇ ਚੱਲਣਾ ਹੈ ਕਿਵੇਂ ਕਿਵੇਂ ਕੀ ਕਰਨਾ ਹੈ ਅਤੇ ਲਾਲ ਬੱਤੀ ਹਰੀ ਬੱਤੀ ਅਤੇ ਪੀਲੀ ਬੱਤੀ ਦਾ ਮਤਲਬ ਵੀ ਦੱਸਣਾ ਉਹਨਾਂ ਨੂੰ ਬਹੁਤ ਜ਼ਿਆਦਾ ਜ਼ਰੂਰੀ ਹੈ ਜੇਕਰ ਇੱਦਾਂ ਨਹੀਂ ਦੱਸੋਗੇ ਤਾਂ ਉਹਨਾਂ ਦੀ ਜ਼ਿੰਦਗੀ ਦੀ ਵੀ ਖਤਰੇ 'ਚ ਆ ਸਕਦੀ ਹੈ ਇਸ ਕਰਕੇ ਪੁਲਿਸ ਵਾਲਿਆਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਵਾਰ ਉਹਨਾਂ ਨੂੰ ਸਕੂਲ ਦੇ ਵਿੱਚ ਜਾ ਕੇ ਲੈਕਚਰ ਦੇਣੇ ਬਹੁਤ ਜ਼ਰੂਰੀ ਹਨ